ਹੈਲੋ ਬਸ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਕਿਵੇਂ ਹੋ ਮੈਂ ਨਾ ਮੈਂ ਮੋਦੀ ਕੋਲਜ ਪਟਿਆਲਾ ਅਤੇ ਮੈਂ ਇੱਕ ਮੇਰੇ ਦੋਸਤ ਨੇ ਵੀ ਪੰਜਾਬੀ ਯੂਨੀਵਸਟੀ ਪਟਿਆਲਾ 'ਚ ਐਡਮੀਸ਼ਨ ਲਿੱਤੀ ਆ ਜੀ ਪਹਿਲੀ ਵਾਰ ਐਕਸਪੀਰੀਐਂਸ ਹੈ ਹੁਣ ਕਿਵੇਂ ਕਿਵੇਂ ਕੀ ਕੀ ਕਰਨਾ ਮੈਨੂੰ ਦੱਸ ਦਿਓ ਇੱਕ ਵਾਰ ਕਿ ਮੈਮ ਨਾਭੇ ਤੋਂ ਆਉਣਾ ਹੈ ਕਿਵੇਂ ਆਪਾਂ ਨੇ ਕਿੱਥੇ ਉਤਰਨਾ ਹੈ ਕਿੱਥੋਂ ਫਿਰ ਕਿਹੜੀ ਔਟੋ ਫੜਨਾ ਹੈ ਕਿਹੜਾ ਬੱਸ ਫੜਨਾ ਕਿਵੇਂ ਕੀ ਕੀ ਕਰਨਾ ਉਹ ਦੱਸ ਦਿਓ ਸਾਰਾ ਹੂੰ ਹੂੰ ਠੀਕ ਹੈ ਵੀਰੇ ਠੀਕ ਹੈ ਮਤਲਬ ਸਵੇਰੇ ਛੇਤੀ ਓ ਨਿਕਲਣਾ ਪੈਣਾ ਘਰੋਂ

ਠੀਕ ਹੈ ਜੀ ਠੀਕ ਹੈ ਜੀ ਹਾਂ ਜਿਵੇਂ ਮੈਂ ਮੋਦੀ 'ਚ ਹਾਂ ਮੈਂ ਇੱਥੋਂ ਬੱਸ ਸਟੈਂਡ ਉ ਥਾਪਰ ਉਤਰ ਗਿਆ ਓਕੇ ਠੀਕ ਹੈ ਜੇ ਵੱਧ ਘੱਟ ਬੋਲਿਆ ਫਿਰ ਕੀ ਕਰਨਾ ਠੀਕ ਹੈ ਅਤੇ ਜਿਹੜਾ ਮੇਰਾ

ਠੀਕ ਹੈ ਜੀ ਠੀਕ ਹੈ ਜੀ ਅਤੇ ਯੂਨੀਵਸਟੀ ਵਾਲੇ ਦਾ ਠੀਕ ਹੈ

ਓਕੇ

ਅਤੇ ਉਹ ਹਾਂ ਅੱਛਾ ਮਤਲਬ ਹੁਣ ਅੱਛਾ ਅਤੇ ਨਵੇਂ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਦਾ ਜਿਹੜਾ ਚੱਕਰ ਹੈ ਉਸ 'ਚ ਕੀ ਕਰਨਾ ਆਪਾਂ ਨੇ ਜੀ ਅੱਛਾ ਠੀਕ ਹੈ ਜੀ ਠੀਕ ਹੈ ਜੀ ਅਤੇ ਟੋਟਲ ਮਤਲਬ ਆਪਾਂ ਨੂੰ ਲੱਗੂਗਾ ਚਾਲੀ ਤੋਂ ਪੰਨਤਾਲੀ ਮਿੰਟ ਪਹੁੰਚਣ ਨੂੰ ਕਿੰਨੀ ਹੋਈ ਯੂਨੀਵਸਟੀ ਤਾਂ ਘੰਟਾ ਲੱਗੂਗਾ ਆਪਾਂ ਨੂੰ ਹੋਰ ਉਹ ਚਲੋ ਜੇ ਇੰਨ ਇੰਨ ਕੇਸ ਆਪਣਾ ਜਿਵੇਂ ਕਹਿੰਦੇ ਜੀ ਸਟ੍ਰਾਈਕ ਹੋ ਗਈ ਬੱਸਾਂ ਦੀ ਫਿਰ ਉਹਦਾ ਕੀ ਕਰਨਾ ਸਮਾਧਾਨ ਕੀ ਹੋਊਗਾ ਫਿਰ ਚਲੋ ਠੀਕ ਹੈ ਜੀ ਚਲੋ ਚਲੋ ਠੀਕ ਹੈ ਜੀ